ਬੁਣਾਈ ਅਤੇ ਸਿਲਾਈ ਨੇ ਮੇਰੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਅਤੇ ਮੈਂ ਇਸ ਦੇ ਨਾਲ ਬਹੁਤ ਸਾਰਾ ਪੈਸਾ ਵੀ ਕਮਾਇਆ ਹੈ ਅਤੇ ਮੈਂ ਲਗਾਤਾਰ ਖੇਡਾਂ ਦੇ ਨਾਲ ਕੰਮ ਵੀ ਕੀਤਾ ਹੈ ਖੇਡਾਂ ਦੇ ਨਾਲ ਕੰਮ ਕਰਨ ਨਾਲ ਮੈਨੂੰ ਸਰੀਰਕ ਦਰਦ ਵੀ ਹੋਇਆ ਹੈ ਇਹਦੇ ਨਾਲ ਮੇਰੀ ਪਿੱਠ ਦੇ ਵਿੱਚ ਦਰਦ ਵੀ ਹੋਈ ਹੈ ਅਤੇ ਮੇਰੀਆਂ ਬਾਹਾਂ ਵੀ ਕਾਫੀ ਦਰਦ ਹੁੰਦੀਆਂ ਨੇ ਕਿਉਂਕਿ ਇਹਦੇ ਨਾਲ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਬਹੁਤ ਬਾਹਾਂ ਨੂੰ ਦੇ ਨਾਲ ਜ਼ੋਰ ਲੱਗਦਾ ਹੈ ਅਤੇ ਮੈਂ ਆਪਣੇ ਸਿਲਾਈ ਦੇ ਜੀਵਨ ਦੇ ਨਾਲ ਸਿਲਾਈ ਕਰ ਕਰ ਕੇ ਮੈਂ ਆਪਣੇ ਜੀਵਨ ਏ ਆਪਣੇ ਪਰਿਵਾਰ ਨੂੰ ਬਹੁਤ ਆਰਥਿਕ ਮਦਦ ਵੀ ਦਿੱਤੀ ਹੈ ਅਤੇ ਮੈਂ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਵਧੀਆ ਤਰੀਕੇ ਦੇ ਨਾਲ ਜਿਊਣਾ ਸਿਖਾਇਆ ਹੈ ਅਤੇ ਉਹਨਾਂ ਨੂੰ ਪੜ੍ਹਾਈ ਲਿਖਾਈ ਦੇ ਵਿੱਚ ਵੀ ਉਹਨਾਂ ਦਾ ਕਾਫੀ ਮਤਲਬ ਅਹਿਮਅਤ ਦਿੱਤੀ ਹੈ ਅਤੇ ਮੈਂ ਆਪਣੀ ਮਿਹਨਤ ਦੇ ਨਾਲ ਹੀ ਇਹ ਕੰਮ ਕਰਦੀ ਹਾਂ ਕਿਉਂਕਿ ਮੈਨੂੰ ਬਚਪਨ ਦੇ ਵਿੱਚ ਹੀ ਇਸ ਇਹ ਕੰਮ ਕਰਨ ਦਾ ਬਹੁਤ ਸ਼ੌਕ ਸੀ ਬੁਣਾਈ ਕਰਨ ਦਾ ਵੀ ਅਤੇ ਸਿਲਾਈ ਕਰਨ ਦਾ ਵੀ ਸਿਲਾਈ ਕਰ ਕਰ ਕੇ ਮੇਰੇ ਆਲੇ ਦੁਆਲੇ ਮਹੱਲਿਆਂ ਦੇ ਮਹੱਲੇ ਦੇ ਵਿੱਚ ਵੀ ਮੇਰਾ ਕਾਫੀ ਨਾਮ ਹੈ ਅਤੇ ਲੋਕ ਦੂਰ ਦੂਰ ਤੋਂ ਮੇਰੇ ਕੋਲੋਂ ਸਿਲਾਈ ਕਰਵਾਉਣ ਵਾਸਤੇ ਆਉਂਦੇ ਹਨ ਇਹ ਕਿ ਉਹ ਉਹਨਾਂ ਉਹ ਮੇਰੇ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ